ਮਾਰੂਤੀ ਏਟ ਹੰਡਰਡ ਆਲਟੋ ਜੀਪ ਸਕੋਰਪੀਓ ਬਰੀਜ਼ਾ ਵੈਗ ਨਾਰ ਇਨੋਵਾ ਫੋਰਚੂਨਰ ਥਾਰ ਕਰੇਟਾ ਆਈ ਟੈਨ ਆਈ ਟਵੰਟੀ ਐਕਸ ਯੂ ਵੀ ਸੈਵਨ ਹੰਡਰਡ ਸੰਨੀ ਐਕਟੀਵਾ ਚੇਟਕ ਵੈਸਪਾ ਸਪਲੈਂਡਰ ਕੋਲੀ ਬਾਰ ਹੋਂਡਾ ਸਿਟੀ ਵਰਨਾ ਪੈਂਥਰ ਬੁਲਟ ਵੈਨਿਊ